ਸਤਿ ਸ਼੍ਰੀ ਅਕਾਲ ਜੀ ਲੱਕੀ ਢਾਬੇ ਤੋਂ ਗੱਲ ਕਰ ਰਹੇ ਹੋ ਮੈਂ ਮਾਡਲ ਟਾਊਨ ਰੋਪੜ ਵਿਖੇ ਰਹਿੰਦਾ ਹਾਂ ਮੈਂ ਖਾਣ ਲਈ ਕੁਝ ਆਰਡਰ ਕਰਨਾ ਸੀ ਇਸ ਆਰਡਰ ਵਿੱਚ ਦਾਲ ਮੱਖਣੀ ਸ਼ਾਹੀ ਪਨੀਰ ਮਿਕਸ ਵੈਜ ਰਾਇਤਾ ਚਾਵਲ ਮਟਰ ਪਨੀਰ ਅਤੇ ਰੁਮਾਲੀ ਰੋਟੀਆਂ ਤੰਦੂਰੀ ਰੋਟੀਆਂ ਦਾ ਆਰਡਰ ਕਰਨਾ ਚਾਹੁੰਦਾ ਹਾਂ ਅਸਲ 'ਚ ਗੱਲ ਇਹ ਹੈ ਕਿ ਮੈਂ ਨਵੇਂ ਘਰ 'ਚ ਆ ਰਿਹਾ ਹਾਂ ਮੇਰੇ ਨਵੇਂ ਘਰ ਵਿੱਚ ਲੋੜੀਂਦਾ ਸਮਾਨ ਨਹੀਂ ਹੈ ਕਿਰਪਾ ਕਰਕੇ ਮੈਨੂੰ ਲੋੜੀਂਦੇ ਡਿਸਪੋਜ਼ਲ ਪਲੇਟਾਂ ਚਮਚੇ ਗਿਲਾਸ ਆਦਿ ਭੇਜੇ ਜਾਣ ਆਪ ਜੀ ਦਾ ਬਹੁਤ ਬਹੁਤ ਧੰਨਵਾਦ